ਪੋਜੀਟਿਵ ਐਕਸਪੀਰੀਅਸ ਫਸਟ ਪ੍ਰੋਡਕਟ ਬਾਰੇ ਤੋ ਫਸਟ ਪ੍ਰੋਡਕਟ ਜਿਹੜਾ ਮੈਂ ਬਾਏ ਕੀਤਾ ਸੀਗਾ ਉਹ ਸੀਗੀ ਬੁੱਕ ਇੱਕ ਜੋ ਕਿ ਬੁੱਕ ਸੀਗੀ ਪ੍ਰੀਤੀ ਸ਼ੋਨਾਇ ਦੀ ਲਿਖੀ ਹੋਈ ਉਹ ਇੱਕ ਇੰਡੀਅਨ ਔਥਰ ਹੈ ਜਿਸਨੇ ਇੱਕ ਬੁੱਕ ਲਿਖੀ ਸੀਗੀ ਮਾਈ ਸੀਕਰੇਟ ਵਿਸ਼ ਲਿਸਟ ਔਰ ਬੜਾ ਹੀ ਵਧੀਆ ਐਕਸਪੀਰੀਅੰਸ ਰਿਹਾ ਸੀਗਾ ਮੇਰਾ ਉਹ ਦੇਨ ਉਹਨੂੰ ਪੜ੍ਹ ਕੇ ਉਹਦੇ 'ਚ ਕਾਫੀ ਸਾਰੀਆਂ ਵੈਲੂਏਬਲ ਚੀਜ਼ਾਂ ਸੀਗੀਆਂ ਜਿਸ ਤੋਂ ਬੜਾ ਕੁਛ ਸਿੱਖਣ ਨੂੰ ਮਿਲਿਆ ਕਿ ਤੁਸੀਂ ਆਪਣੀ ਲਾਈਫ ਨੂੰ ਜਿਹੜਾ ਹੈ ਉਹ ਕਿੱਦਾਂ ਆਪਣੇ ਅਕੋਡਿੰਗਲੀ ਅਮੈਨੇਜ ਕਰ ਸਕਦੇ ਹੋ ਜਦੋਂ ਮੁਸ਼ਕਿਲ ਸਿਚੁਏਸ਼ਨਾਂ ਆਉਂਦੀਆਂ ਨੇ ਤਾਂ ਉਹ ਤੋਂ ਆਪਣੇ ਆਪ ਨੂੰ ਕਿੱਦਾਂ ਬੈਕ ਅਪ ਕਰਨਾ ਹੈ ਕਿ ਕਿਉਂਕਿ ਲਾਈਫ ਜਿਹੜੀ ਹੈਗੀ ਆ ਉਹ ਅਪਸ ਐਂਡ ਡਾਊਨਸ ਦਾ ਸੁਮੇਲ ਹੈ ਦੋਨੋਂ ਚੀਜ਼ਾਂ ਇਕੱਠੀਆਂ ਇਕੱਠੀਆਂ ਤਾਂ ਨਹੀਂ ਚੱਲਦੀਆਂ ਬਟ ਹਾਂ ਜੇ ਅਪਸ ਆ ਰਹੇ ਨੇ ਤੁਹਾਡੀ ਲਾਈਫ ਦੇ ਵਿੱਚ ਤਾਂ ਅਡਾਊਨਜ਼ ਵੀ ਆਉਂਦੇ ਨੇ ਅਤੇ ਜੇ ਤੁਸੀਂ ਅਪਸ ਆਉਂਦੇ ਨੇ ਤਾਂ ਬਹੁਤ ਖੁਸ਼ ਹੁੰਦੇ ਹੋ ਉਸ ਚੀਜ਼ ਨੂੰ ਮੇਨਟੇਨ ਕਰਕੇ ਰੱਖੋ ਬਟ ਜੇ ਡਾਊਨ ਕਦੇ ਤੁਹਾਡੀ ਲਾਈਫ 'ਚ ਆ ਰਿਹਾ ਤਾਂ ਫਿਰ ਤੁਸੀਂ ਉਸ ਤੋਂ ਉਭਰਨਾ ਕਿੱਦਾਂ ਆਪਣੇ ਆਪ ਨੂੰ ਪੋਜੀਟਿਵ ਕਿੱਦਾਂ ਰੱਖਣਾ ਮੈਡੀਟੇਸ਼ਨ ਕਰਨੀ ਹੈ ਜਾਂ ਮਿਊਜ਼ਿਕ ਸੁਣਨਾ ਹੈ ਤਾਂ ਜਦੋਂ ਤੁਸੀਂ ਮਿਊਜ਼ਿਕ ਸੁਣਦੇ ਹੋ ਤੁਹਾਡਾ ਕਾਫੀ ਕਾਮ ਮਹਿਸੂਸ ਕਰਦੇ ਹੋ ਕਾਫੀ ਪੀਸਫੁਲ ਮਹਿਸੂਸ ਕਰਦੇ ਹੋ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਮਿਊਜ਼ਿਕ ਹੋਵੇ ਅਤੇ ਜੇ ਤੁਸੀਂ ਮੈਡੀਟੇਸ਼ਨ ਕਰਦੇ ਹੋ ਤਾਂ ਉਹ ਵੀ ਤੁਹਾਨੂੰ ਕਾਫੀ ਹੱਦ ਤੱਕ ਸਕੂਨ ਦਿੰਦੀ ਹੈ ਔਰ ਸਮਝਣ ਦੀ ਤੁਹਾਡਾ ਮਨ ਜਦੋਂ ਸ਼ਾਂਤ ਹੁੰਦਾ ਦਿਮਾਗ ਜਦੋਂ ਸ਼ਾਂਤ ਹੁੰਦਾ ਉਦੋਂ ਤੁਸੀਂ ਆਪਣੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਉਹਨਾਂ ਦੇ ਸਲਿਊਸ਼ਨ ਜਿਹੜੇ ਨੇ ਉਹ ਸੋਚ ਸਕਦੇ ਹੋ ਤਾਂ ਉਹ ਮੇਰਾ ਕਾਫੀ ਅੱਛਾ ਐਕਸਪੀਰੀਅਸ ਰਿਹਾ ਸੀਗਾ ਉਸ ਕਿਤਾਬ ਨੂੰ ਲੈ ਕੇ ਜਦੋਂ ਮੈਂ ਉਸਨੂੰ ਪੜ੍ਹਿਆ ਸੀਗਾ ਤਾਂ ਥੈਂਕ ਯੂ